ਮੋਹਾਲੀ ਜ਼ਿਲ੍ਹੇ ਵਿੱਚ ਫਸਲਾਂ ਪ੍ਰਮੁੱਖ ਤੌਰ 'ਤੇ ਕਣਕ ਚੌਲ਼ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਪਸ਼ੂ ਧਨ ਦੇ ਉਦਯੋਗ ਲਈ ਮੰਡੀਆਂ ਬਣਾਈਆਂ ਹਨ ਸਿੰਚਾਈ ਦੇ ਲਈ ਟਿਊਵੈੱਲ ਅਤੇ ਮੋਟਰਾਂ ਹਨ ਖੇਤੀ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ